ਮੇਰਾ ਨਾਮ ਰਮਨਦੀਪ ਸਿੰਘ ਹੈ ਅਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਤੁਹਾਡੇ ਰੈਸਟੋਰੈਂਟ ਤੋਂ ਕੁਛ ਆਰਡਰ ਕਰਨ ਦੇ ਲਈ ਅੱਗੇ ਆਰਡਰ ਕੀਤਾ ਸੀ ਅਤੇ ਹੁਣ ਉਹਦੇ ਵਿੱਚ ਤੁਸੀਂ ਆਰਡਰ ਦੀਆਂ ਆਈਟਮਾਂ ਵਿੱਚੋਂ ਇੱਕ ਆਈਟਮ ਹੈ ਮਿਸ ਕਰ ਦਿੱਤੀ ਹੈ ਜਿਹੜਾ ਮੈਂ ਆਰਡਰ ਕੀਤਾ ਸੀ ਉਹਦੇ ਵਿੱਚ ਪਹਿਲਾਂ ਮੈਂ ਆਪਣਾ ਪੁਰਾਣਾ ਔਰਡਰ ਦੇ ਵਿੱਚ ਆਈਟਮਾਂ ਬੋਲ ਰਿਹਾ ਹਾਂ ਇੱਕ ਦਾਲ ਮਖਣੀ ਇੱਕ ਕੜਾਹੀ ਪਨੀਰ ਅਤੇ ਤਿੰਨ ਬਟਰ ਨਾਨ੍ਹ ਇਹ ਸਾਰਾ ਜੋ ਮੈਂ ਆਰਡਰ ਕੀਤਾ ਸੀਗਾ ਇਸ ਦੇ ਵਿੱਚ ਮੈਂ ਡੈਜ਼ਟ ਆਈਟਮ ਐਡ ਕਰਨਾ ਭੁੱਲ ਗਿਆ ਸੀਗਾ ਕਿਰਪਾ ਕਰਕੇ ਇੱਕ ਡੈਜਟ ਵਾਲੀ ਆਈਟਮ ਨੂੰ ਐਡ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜਿਹਦੇ ਵਿੱਚ ਇੱਕ ਆਈਸਕ੍ਰੀਮ ਆ ਜਾਏਗੀ ਬਟ੍ਰਸਕੋਚ ਫਲੇਵਰ ਅਤੇ ਦੋ ਗੁਲਾਬ ਜਾਮੁਨ ਇਹਦੇ ਵਿੱਚ ਐਡ ਅਪ ਕਰਕੇ ਮੇਰਾ ਜੋ ਵੀ ਬਣਦਾ ਬਿਲ ਹੈ ਉਸਨੂੰ ਤੁਸੀਂ ਮੇਰੇ ਖਾਤੇ ਦੇ ਵਿੱਚ ਰਿਫਲੈਕਟ ਕਰ ਦਿਓ ਤਾਂ ਕਿ ਮੈਂ ਇਸਦਾ ਭੁਕ ਭੁਗਤਾਨ ਸਮੇਂ ਸਿਰ ਕਰ ਸਕਾਂ ਆਪਦਾ ਬਹੁਤ ਧੰਨਵਾਦੀ ਹੋਵਾਂਗਾ ਥੈਂਕ ਯੂ